ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀ ਵੀ ਮੁਕਤਸਰ ਤੁਸੀਂ ਮੁਕਤਸਰ ਦੇ ਰਹਿਣ ਵਾਲੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਹੁਣ ਮੁਕਤਸਰ ਵਿੱਚ ਕੀ ਕੀ ਤਬਦੀਲੀਆਂ ਆ ਰਹੀਆਂ ਨੇ ਹਾਂਜੀ

ਅੱਛਾ

ਹਾਂਜੀ ਹੋਰ ਕੀ ਕੀ ਤਬਦੀਲੀ ਹੋਈ ਦੱਸ ਸਕਦੇ ਹੋ ਠੀਕ ਐ ਜੀ ਤੁਸੀਂ ਮੁਕਤਸਰ ਦੇ ਰਹਿਣ ਵਾਲੇ ਹੋ ਠੀਕ ਤੇ ਹੋਰ ਕੁਝ ਦੱਸ ਸਕਦੇ ਹੋ ਮੈਨੂੰ ਮੁਕਤਸਰ ਬਾਰੇ ਕਿਵੇਂ ਓਕੇ ਜੀ ਨਹੀਂ ਬਸ ਮੈ ਪੁੱਛਣਾ ਇਹੀ ਪੁੱਛਣਾ ਸੀ ਜੀ ਕੀ ਤਬਦੀਲੀਆਂ ਆ ਰਹੀਆਂ ਨੇ ਮੁਕਤਸਰ ਚ ਹਾਂਜੀ ਓਕੇ ਮੈਮ ਥੈਂਕਯੂ